ਦੋ ਜਨਵਰੀ ਵੀਹ ਗਿਆਰ੍ਹਾਂ ਤਿੰਨ ਦਸੰਬਰ ਵੀਹ ਪੰਦਰ੍ਹਾਂ ਪੰਦਰ੍ਹਾਂ ਫਰਵਰੀ ਵੀਹ ਸਤਾਰ੍ਹਾਂ ਵੀਹ ਅਪ੍ਰੈਲ ਵੀਹ ਉੱਨੀ ਸਤਾਰ੍ਹਾਂ ਮਈ ਵੀਹ ਬਾਈ